ਅੱਜ ਦੇ ਸਮਾਜ ਅਤੇ ਪੁਰਾਣੇ ਦੇ ਸਮਾਜ ਵਿੱਚ ਔਰਤਾਂ ਜੋ ਡਾਂਸ ਨੂੰ ਆਪਣੇ ਸ਼ੌਂਕ ਦੇ ਵਜੋਂ ਜਾਰੀ ਰੱਖਣਾ ਚਾਹੁੰਦੀ ਆ ਸਾ ਸਮਾਜ ਨੇ ਹਮੇਸ਼ਾ ਹੀ ਉਸਦਾ ਵਿਰੋਧ ਕੀਤਾ ਹੈ ਇਸਦੇ ਨਾਲ ਈ ਇਨ੍ਹਾਂ ਜੋ ਕੁੜੀਆਂ ਨੂੰ ਕਈ ਸਾਰੀਆਂ ਚੁਣੌਤੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਪੈਂਦਾ ਸੀ ਇਸਦੇ ਨਾਲ ਉਨ੍ਹਾਂ ਨੂੰ ਕਈ ਗੰਦੇ ਵਰਡਸ ਦੇ ਨਾਲ ਜੋ ਕੀ ਸਮਾਜ ਦੇ ਵਿੱਚ ਚੱਲਦੇ ਸਨ ਉਨ੍ਹਾਂ ਦੇ ਨਾਲ ਪੁਕਾਰਿਆ ਜਾਂਦਾ ਸੀ ਪਰ ਇਹ ਵਰਡ ਬੋਲਣ ਲੱਗਿਆ ਵੀ ਅੱਜ ਸਾਨੂੰ ਸ਼ਰਮ ਆਉਂਦੀ ਹੈ ਕਿਉਂਕੀ ਉਨ੍ਹਾਂ ਦਾ ਕੋਈ ਸਤਿਕਾਰ ਨੀ ਕੀਤਾ ਜਾਂਦਾ ਕੋਈ ਉਨ੍ਹਾਂ ਦਾ ਮਾਣ ਨੀ ਕੋਈ ਉਨ੍ਹਾਂ ਦੀ ਇੱਜਤ ਨੀ ਰੱਖੀ ਜਾਂਦੀ ਜੋ ਕੀ ਆਪਣੇ ਡਾਂਸ ਨੂੰ ਇੱਕ ਸ਼ੌਂਕ ਦੇ ਵਜੋਂ ਜਾਰੀ ਰੱਖਣਾ ਚਾਹੁੰਦੀਆਂ ਸਨ ਕਈ ਵਾਰ ਤਾਂ ਏਦਾਂ ਵੀ ਹੁੰਦਾ ਸੀ ਕੀ ਉਨ੍ਹਾਂ ਦੇ ਮਾਤਾ ਪਿਤਾ ਵੀ ਉਨ੍ਹਾਂ ਦਾ ਸਾਥ ਨਹੀਂ ਦਿੰਦੇ ਸਨ ਉਨ੍ਹਾਂ ਨੂੰ ਲੱਗਦਾ ਸੀ ਕੀ ਉਸ ਉਨ੍ਹਾਂ ਦੇ ਉਨ੍ਹਾਂ ਦੇ ਇਸ ਸ਼ੌਂਕ ਦੇ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਜਾਂ ਕਿਸੇ ਮੈਂਬਰ ਨੂੰ ਅੱਗੇ ਜਾ ਕੇ ਵੱਡੀਆਂ ਸਮੱਸਿਆਵਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਉਹ ਉਨ੍ਹਾਂ ਨੂੰ ਘਰੋਂ ਬਾਹਰ ਕੱਡ ਦਿੰਦੇ ਉਨ੍ਹਾਂ ਦਾ ਕੋਈ ਸਾਥ ਨੀ ਦਿੰਦੇ ਤੇ ਸਮਾਜ ਨੇ ਉਨ੍ਹਾਂ ਨੂੰ ਕਈ ਗੰਦੇ ਨਾਵਾਂ ਦੇ ਨਾਲ ਪੁਕਾਰਨ ਲੱਗ ਪਿਆ ਇਸਦੇ ਨਾਲ ਕਿ ਉਨ੍ਹਾਂ ਹੌਂਸਲਾ ਟੁੱਟ ਜਾਵੇ ਉਹ ਇਹ ਸ਼ੌਂਕ ਨੂੰ ਛੱਡ ਦੇਣ ਪਰ ਕਈ ਬਹੁਤ ਹਿੰਮਤ ਵਾਲੀਆਂ ਹੁੰਦੀਆਂ ਸਨ ਜੋ ਆਪਣੇ ਸ਼ੌਂਕ ਨੂੰ ਜਾਰੀ ਰੱਖਦੀਆਂ ਸਨ ਤੇ ਸਹੀ ਵੀ ਰਹਿੰਦੀਆਂ ਸਨ ਇਸਦੇ ਨਾਲ ਉਹ ਆਪਣੇ ਸ਼ੌਂਕ ਨੂੰ ਪੂਰਾ ਕਰਦੀਆਂ ਅਤੇ ਆਪਣੇ ਜਿਹੜੇ ਲੋੜੀਂਦੀਆਂ ਸਮਾਨ ਹੁੰਦਾ ਉਨ ਦੇ ਲਈ ਵੀ ਆਪਣੀ ਆਮਦਨੀ ਕੱਠੀ ਕਰ ਲੈਂਦੀਆਂ ਸਨ